ਹਾਂਜੀ ਵੀਰ ਜੀ ਸਿਲੰਡਰ ਲੈ ਕੇ ਆਏ ਹੋ ਲੈ ਆਏ ਸਿਲੰਡਰ ਚਲੋ ਬਾਹਰ ਤਾਂ ਆ ਜਾਂਦਾ ਅਤੇ ਇਹ ਸਿਲਿੰਡਰ ਜਿਹੜਾ ਤੁਸੀਂ ਦੇ ਕੇ ਜਾਂਦੇ ਹੋ ਉਹਦਾ ਤਾਂ ਵੇਟ ਘੱਟ ਸੀਗਾ ਪਿਛਲੀ ਵਾਰ ਨਹੀਂ ਹੁਣ ਗੱਲ ਇੱਦਾਂ ਵੀ ਦੇਖੋ ਸਾਡੇ ਸਿਲੰਡਰ ਚੱਲਦਾ ਸੀ ਪਹਿਲਾਂ ਮਹੀਨਾ ਹੁਣ ਚੱਲਿਆ ਸਾਰਾ ਵੀਹ ਦਿਨ ਇਹਦਾ ਮਤਲਬ ਉਹਦੇ 'ਚ ਗੈਸ ਘੱਟ ਸੀਗੀ ਫਿਰ ਨਾ ਸਾਨੂੰ ਨਾ ਨਾ ਸਾਨੂੰ ਪਤਾ ਹੈਗਾ ਵੀ ਸਾਡੇ ਸਿਲੰਡਰ ਕਿੰਨਾ ਚੱਲਦਾ ਅਸੀਂ ਕਿਹੜਾ ਪਹਿਲੇ ਦਿਨ ਵਰਤਣ ਲੱਗੇ ਆਂ ਅਸੀ ਤਾਂ ਇੰਨੇ ਸਾਲ ਹੋ ਗਏ ਗੈਸ ਵਰਤਦੇ ਨੂੰ ਸਿਲੰਡਰ 'ਚ ਗੈਸ ਗੂਸ ਕੱਢ ਲੈਂਦੇ ਹੋਣੇ ਰਾਹ ਦੇ ਵਿੱਚ ਨਹੀਂ ਨਹੀਂ ਇੱਦਾਂ ਇੱਦਾਂ ਨਹੀਂ ਹੈਗਾ ਇਹ ਤਾਂ ਜ਼ਿਆਦਾ ਦੇਖੋ ਜਿੰਨਾ ਸਿਲੰਡਰ ਦਾ ਵਜ਼ਨ ਹੈ ਤੁਸੀਂ ਜਾਂ ਤਾਂ ਵਜ਼ਨ ਕਰਕੇ ਸਾਡੇ ਸਾਹਮਣੇ ਫਿਰ ਜਾਇਆ ਕਰੋ ਹੁਣ ਤੁਸੀਂ ਸਿਲੰਡਰ ਲਿਆਏ ਹੁਣ ਅਗਲੀ ਵਾਰ ਕੀ ਪਤਾ ਇਹਦੇ ਵਿੱਚ ਵੀ ਘੱਟ ਹੋਵੇ ਗੈਸ ਨਹੀਂ ਨਹੀਂ ਵੀਰ ਜੀ ਗੱਲ ਇਹ ਹੈ ਵੀ ਹੁਣ ਹਰ ਵਾਰ ਅਸੀਂ ਟਰੱਕ 'ਤੇ ਥੋੜ੍ਹੇ ਚੜਾਂਗੇ ਹੁਣ ਜੇ ਮੰਨ ਲਓ ਤੁਸੀਂ ਕਹਿਣਾ ਕਸਟਮਰ ਕੇਅਰ 'ਤੇ ਗੱਲ ਕਰ ਲਓ ਫਿਰ ਤੁਸੀਂ ਕਹੋਗੇ ਸਾਡੀ ਕੰਪਲੇਂਟ ਕਰਤੀ ਇਹ ਤਾਂ ਹੁਣ ਜਿਹੜਾ ਬੰਦਾ ਸਿਲੰਡਰ ਦੇਖੋ ਹੁਣ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਦੇਖੋ ਦੇਖੋ ਵੀ ਕਾਨੂੰਨ ਮੁਤਾਬਿਕ ਤਾਂ ਇਹ ਹੈ ਵੀ ਤੁਹਾਨੂੰ ਨਾਲ ਆਪਣਾ ਕੰਡਾ ਲੈ ਕੇ ਆਉਣਾ ਚਾਹੀਦਾ ਹੈ ਕਸਟਮਰ ਦੇ ਸਾਹਮਣੇ ਤੋਲ ਕੇ ਦਿਖਾਉਣਾ ਚਾਹੀਦਾ ਵੀ ਦੇਖੋ ਜੀ ਗੈਸ ਜਿਹੜੀ ਆ ਬਿਲਕੁਲ ਪੂਰੀ ਹੈ ਨਹੀਂ ਅਤੇ ਪਹਿਲਾਂ ਤਾਂ ਕਦੇ ਦਿੱਕਤ ਨਹੀਂ ਆਈ ਇੱਦਾਂ ਦੀ ਚਲੋ ਅਸੀਂ ਵੀ ਦੇਖਾਂਗੇ ਤੁਸੀਂ ਇੱਦਾਂ ਕਰੋ ਨਾ ਇੱਕ ਕੰਡਾ ਆਪਣਾ ਖਰੀਦ ਲਓ ਅਤੇ ਉਸ ਨਾਲ ਸਾਨੂੰ ਤੋਲ ਦਓ ਨਾਲ ਤਾਂ ਤੁਹਾਡਾ ਟਾਈਮ ਬਚਿਆ ਕਰੇਗਾ ਅਤੇ ਨਾਲ ਸਾਨੂੰ ਤਸੱਲੀ ਹੋ ਜਾਇਆ ਕਰੇਗੀ ਇੱਕੋ ਵਾਰ ਕੰਡੇ 'ਤੇ ਪੈਸੇ ਲੱਗਣੇ ਨਹੀਂ ਤਾਂ ਕੰਪਨੀ ਵੱਲ ਕਹਿ ਦਓ ਕੰਪਨੀ ਵਾਲੇ ਦੇ ਦੇਣਗੇ ਤੁਹਾਨੂੰ

ਨਹੀਂ ਉਹ ਜਿਹੜਾ ਲਟਕਣ ਜਿਹੇ ਵਾਲਾ ਹੁੱਕ ਜਿਹੀ ਵਾਲਾ ਕੰਡਾ ਨਹੀਂ ਹੁੰਦਾ ਸਪ੍ਰਿੰਗ ਵਾਲਾ ਉਹ ਦੇ ਲੈ ਲਓ ਨਹੀਂ ਤਾਂ ਫਿਰ ਉਹਦਾ ਸਲਿੰਡਰ ਦੇ ਉੱਤੇ ਦੇਖੋ ਲਿਖਿਆ ਹੋਇਆ ਵੀ ਖਾਲੀ ਦਾ ਵਜ਼ਨ ਕਿੰਨਾ ਬਾਕੀ ਟੋਟਲ ਕਿੰਨਾ ਉਹ ਆਪਾਂ ਗੈਸ ਦਾ ਕੱਢ ਲਵਾਂਗੇ ਜਿੰਨਾਂ ਚੌਦ੍ਹਾਂ ਕਿਲੋ ਕਿੰਨਾ ਛੇ ਸੌ ਗ੍ਰਾਮ ਜਿੰਨਾ ਵੀ ਹੁੰਦਾ ਹੈਗਾ ਕਿ ਨਹੀਂ

ਚਲੋ ਅਗਲੀ ਵਾਰ ਫਿਰ ਤੁਸੀਂ ਲੈ ਕੇ ਆਇਓ ਹੈ ਨਾ ਫਿਰ ਤੁਸੀਂ ਕੰਡੇ 'ਤੇ ਤੋਲ ਕੇ ਦਇਓ ਨਾ ਫਿਰ ਹੁਣ ਦੋ ਦਿਨ ਦੋ ਦਿਨ ਬਾਅਦ 'ਚ ਦੇ ਦਿਓ ਕੋਈ ਗੱਲ ਨਹੀਂ ਤੋਲ ਕੇ ਦਇਓ ਹੁਣ ਠੀਕ ਹੈ ਠੀਕ ਹੈ ਠੀਕ ਹੈ